ਰੂਪਨਗਰ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਸਥਾਨ ਸੱਭਿਆਚਾਰ ਦਾ ਮੰਨਿਆ ਜਾਂਦਾ ਹੈ ਉਰੇ ਇੱਕ ਪਾਰਕ ਹੈ ਜਿੱਥੇ ਸਾਰੇ ਅਸੀਂ ਇਕੱਠੇ ਹੁੰਦੇ ਹਨ ਅਤੇ ਸੱਭਿਆਚਾਰ ਬਾਰੇ ਪੜ੍ਹਦੇ ਹਨ ਉਰੇ ਇੱਕ ਛੋਟਾ ਜਿਹਾ ਮੂਵੀ ਥੀਏਟਰ ਲਗਾ ਦਿੱਤਾ ਜਾਂਦਾ ਹੈ ਜਿੱਥੇ ਸਾਰੇ ਸੱਭਿਆਚਾਰ ਦਾ ਸਾਨੂੰ ਗਿਆਨ ਦਿੱਤਾ ਜਾਂਦਾ ਹੈ ਅਤੇ ਸਾਡੇ ਪੁਰਖਾਂ ਵਗੈਰਾ ਨੇ ਸਾਡੇ ਲਈ ਕਿਵੇਂ ਕੁਰਬਾਨੀਆਂ ਦਿੱਤੀ ਉਹ ਸਭ ਕੁਝ ਸਾਨੂੰ ਦੱਸਿਆ ਜਾਂਦਾ ਹੈ